ਇਹ ਜਿਹੜਾ ਸਾਡਾ ਭੰਗੜਾ ਹੈ ਇਹ ਖੁਸ਼ੀ ਦਾ ਪ੍ਰਤੀਕ ਹੈ ਜਿਵੇਂ ਕਹਿ ਲਓ ਕਿ ਭੰਗੜਾ ਜਿਹੜਾ ਹੈ ਉਹ ਵਿਆਹਾਂ ਸ਼ਾਦੀਆਂ 'ਤੇ ਜਾਂ ਕਿਸੇ ਤਿਉਹਾਰ 'ਤੇ ਜਾਂ ਕਿਸੇ ਜਿਵੇਂ ਤਿਉਹਾਰ ਜਿਵੇਂ ਬਸੰਤ ਹੋ ਗਈ ਵਿਸਾਖੀ ਹੋ ਗਈ ਇਹਨਾਂ ਦੇ ਉੱਤੇ ਪਾਇਆ ਜਾਂਦਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਜਿਹੜਾ ਭਾਰ ਜਿਹੜਾ ਪੰਜਾਬ ਹੈ ਉਹ ਅਤੇ ਜਿਹੜਾ ਪੰਜਾਬ ਦੇ ਲੋਕ ਨੇ ਉਹ ਖੁਸ਼ ਅਤੇ ਤੰਦਰੁਸਤ ਰਹਿੰਦੇ ਹਨ ਕਿਉਂਕਿ ਇਹ ਖੁਸ਼ੀ ਦਾ ਪ੍ਰਤੀਕ ਹੈ ਅਤੇ ਖੁਸ਼ੀ ਦਰਸਾਉਂਦਾ ਹੈ ਅਤੇ ਹੋਰ ਕਹਿ ਲਓ ਦੂਜੀ ਗੱਲ ਜਿਹੜੀ ਹੈ ਉਹ ਇਹਦੇ ਜਿਹੜੇ ਭੰਗੜੇ ਦੇ ਰੰਗਲੇ ਪਹਿਰਾਵੇ ਹਨ ਉਹ ਸਾਡਾ ਅਮੀਰ ਜਿਹੜਾ ਹੈ ਸੱਭਿਆਚਾਰ ਉਹਨੂੰ ਦਰਸਾਉਂਦਾ ਹੈ ਜਿਵੇਂ ਕਿ ਤੁਰਲੇ ਵਾਲੀਆਂ ਪੱਗਾਂ ਖੁੱਲ੍ਹਾ ਚਾਦਰਾ ਚੱਕਵੀਂਆਂ ਚਕਵੇਂ ਕੁੜਤੇ ਕੱਢਵੀਂਆਂ ਜੁੱਤੀਆਂ ਗਲਾਂ 'ਚ ਕੈਂਠੇ ਇਹ ਸਭ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਰੰਗਲੇ ਪਹਿਰਾਵੇ ਨੂੰ ਦਰਸਾਉਂਦੇ ਹਨ ਜਿਹੜਾ ਦਿਖਾਉਂਦੇ ਨੇ ਕਿ ਪੰਜਾਬ ਦਾ ਜਿਹੜਾ ਪਹਿਰਾਵਾ ਹੈ ਉਹ ਬੜਾ ਅਮੀਰ ਹੈ ਅਤੇ ਹੋਰ ਗੱਲ ਇਹ ਹੈ ਕਿ ਜਿਹੜਾ ਇਹ ਭੰਗੜਾ ਹੈ ਇਹ ਹਮੇਸ਼ਾ ਇਕੱਠ ਦੇ ਵਿੱਚ ਪਾਇਆ ਜਾਂਦਾ ਹੈ ਯਾਰੀ ਦੋਸਤੀ ਦਾ ਪ੍ਰਤੀਕ ਹੈ ਖੁਸ਼ੀ ਦਾ ਪ੍ਰਤੀਕ ਹੈ ਭੰਗੜਾ ਜਿਹੜਾ ਹੈ ਉਹ ਬਹੁਤ ਵੱਡੇ ਪੱਧਰਾਂ 'ਤੇ ਵੀ ਪਾਇਆ ਜਾਂਦਾ ਹੈ ਦਿਖਾਉਂਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਬਹੁਤ ਵੱਡੇ ਪੱਧਰਾਂ 'ਤੇ ਪਹੁੰਚ ਚੁੱਕਾ ਹੈ